ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੁਰਾਣੀਆਂ ਸੱਭਿਆਚਾਰ ਦੇਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਮਿੱਟੀ ਦੇ ਭਾਂਡੇ ਘੁਮਿਆਰ ਅ ਜੁੱ ਪੰਜਾਬੀ ਜੁੱਤੀ ਫੁਲਕਾਰੀ ਚੁੰਨੀ ਫੁਲਕਾਰੀ ਸੂਟ ਪੁਰਾਣੀ ਸੱਭਿਅਤਾ ਜੋ ਅੱਜ ਤੱਕ ਅੰਮ੍ਰਿਤਸਰ ਵਿੱਚ ਚਲਦੀ ਪਈ ਆ ਲੋਕ ਆਪਣੀ ਪੁਰਾਣੀ ਪੀੜ੍ਹੀ ਨੂੰ ਲੈ ਕੇ ਅੱਜ ਤੱਕ ਹਲੀ ਤੱਕ ਉਹ ਸੱਭਿਆਚਾਰ ਨੂੰ ਕਾਇਮ ਰੱਖਿਆ ਹੋਇਆ ਵਾ ਹਲੀ ਤੱਕ ਫੁਲਕਾਰੀ ਜੁੱਤੀ ਫੁਲਕਾਰੀ ਚੁੰਨੀ ਪੰਜਾਬੀ ਜੁੱਤੀ ਕਿੰਨੀ ਚੱਲਦੀ ਆ ਈਵਨ ਕਿ ਅ ਸ਼ੋਪਸ 'ਤੇ ਵੀ ਮਿਲਦੀ ਆ ਅੱਜ ਕੱਲ੍ਹ ਸੱਭਿਆਚਾਰ ਸਾਡਾ ਅੱਜ ਤੱਕ ਹਲੀ ਵੀ ਚੱਲਦਾ ਆਈ ਚੱਲਦਾ ਪਿਆ ਵਾ ਅੰਮ੍ਰਿਤਸਰ ਵਿੱਚ ਅਤੇ ਇੰਝ ਹੀ ਇਹ ਕਲਾ ਅਹ ਅ ਪੀੜ੍ਹੀ ਦਰ ਪੀੜ੍ਹੀ ਚੱਲੀ ਜਾਂਦੀ ਆ ਜਿਵੇਂ ਕਿ ਓ ਪੁਰਾਣੇ ਸਮੇਂ ਵਿੱਚ ਦਾਦਾ ਪੜਦਾਦਾ ਕਰਦੇ ਸੀ ਅਤੇ ਅੱਜ ਉਹਨਾਂ ਦੇ ਬੱਚੇ ਅੱਗਿਓ ਕਰਦੇ ਆ ਜਿੱਦਾਂ ਉਹਨਾਂ ਦੇ ਬੇਟਾ ਅੱਗਿਓ ਪੋਤਰਾ ਸਾਰੇ ਉਹਨਾਂ ਦੇ ਓਈ ਅ ਚੀਜ਼ਾਂ ਹਾਲੇ ਤੱਕ ਕਰਦੇ ਹਨ ਜਿੱਦਾਂ ਘੁਮਿਆਰ ਪੇ ਅ ਮਿੱਟੀ ਦੇ ਭਾਂਡੇ ਅ ਅਹ ਜਿੱਦਾਂ ਸ਼ੋਲਾਂ ਦਾ ਕਿੰਨਾ ਕੰਮ ਹੈ ਅੱਜ ਕੱਲ੍ਹ ਜਿਹੜੇ ਸ਼ੋਲ ਬਣਾਉਂਦੇ ਉਹ ਪਹਿਲੇ ਦਾਦੇ ਪੜਦਾਦੇ ਬਣਾਉਂਦੇ ਸੀ ਅਨ ਉਹਨਾਂ ਦੇ ਬੱਚੇ ਬਣਾਉਂਦੇ ਹਨ ਅਤੇ ਉਹ ਫਿਰ ਉਹ ਵੇਚਦੇ ਹਨ ਕਿੰਨੇ ਹੀ ਅੰਮ੍ਰਿਤਸਰ ਵਿੱਚ ਸਭ ਪੁਰਾਣਾ ਸੱਭਿਆਚਾਰ ਹਜੇ ਤੱਕ ਚੱਲਦਾ ਪਿਆ ਵਾ ਜਿੱਦਾਂ ਕਿ ਪੁਰਾਣੇ ਭਾਂਡੇ ਪੁਰਾਣੀ ਜੁੱਤੀਆਂ ਪੁਰਾਣੇ ਸਭ ਕੁਛ ਅੱਜ ਤੱਕ ਹਜੇ ਤੱਕ ਉਹ ਚੀਜ਼ਾਂ ਚੱਲਦੀਆਂ ਪਈਆਂ ਹਨ ਪੀੜ੍ਹੀ ਦਰ ਪੀੜ੍ਹੀ ਚੱਲੀ ਜਾਂਦੀ ਹੈ ਆਉਣ ਵਾਲੇ ਸਮੇਂ 'ਚ ਵੀ ਕੀ ਪਤਾ ਹਲ ਚਲਦੀ ਰਹਿਣ ਤੇ ਵਧੀਆ ਗੱਲ ਆ ਸਗੋਂ ਕਿ ਅਸੀਂ ਇੰਝ ਹੀ ਆਪਣੇ ਮਾਂ ਪਿਓ ਤੋਂ ਦਾਦਾ ਪੜਦਾਦਿਆ ਕੋਲੋਂ ਚੀਜ਼ਾਂ ਸਿੱਖੀਆਂ ਅਤੇ ਹਜੇ ਵੀ ਉਹ ਕੰਮ ਆਉਂਦੀਆ ਪਈਆਂ ਵਾਂ ਬੱਚਿਆਂ ਦੇ ਅਤੇ ਇੰਝ ਹੀ ਅਮ ਅੱਗੇ ਵੀ ਆਉਂਦੇ ਰਹਿਣ